ਹੈਲੋ ਸਤਿ ਸ਼੍ਰੀ ਅਕਾਲ ਵਧੀਆ ਜੀ ਤੁਸੀਂ ਸੁਣਾਓ ਕੰਮ ਕਾਰ ਤਾਂ ਵਧੀਆ ਬਸ ਹੁਣ ਅੱਗੇ ਸਪੋਰਟਸ ਅਕੈਡਮੀ ਜੁਆਇਨ ਕਰਨ ਬਾਰੇ ਸੋਚ ਰਹੀ ਹਾਂ ਪਰ ਇਹ ਨਹੀਂ ਸਮਝ ਆ ਰਹੀ ਵੀ ਆਪਾਂ ਕਿਹੜੀ ਅਕੈਡਮੀ ਹੁਣ ਅੱਗੇ ਜੁਆਇਨ ਕਰੀਏ ਅੱਛਾ ਜੀ ਓਕੇ ਜੀ ਮੈਨੂੰ ਦੱਸੋਗੇ ਤੁਸੀਂ ਵੀ ਕਿਹੜੀ ਅਕੈਡਮੀ ਤਾਂ ਜੋ ਮੈਂ ਵੀ ਦੇਖ ਪਾਵਾਂ ਅਤੇ ਫਿਰ ਆਪਾਂ ਇਕੱਠੇ ਜੁਆਇਨ ਕਰ ਲਾਂਗੇ ਓਕੇ ਜੀ ਹਾਂਜੀ ਹਾਂਜੀ ਓਕੇ ਹਾਂਜੀ ਹਾਂਜੀ ਉਹਨਾਂ ਦਾ ਵੀ ਬਹੁਤ ਨਾਮ ਸ ਸੁਣਿਆ ਅੱਛਾ ਜੀ ਓਕੇ ਪਰ ਮੈਂ ਸੋਚ ਰਹੀ ਸੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਅਕੈਡਮੀ ਆ ਆਪਾਂ ਉੱਥੇ ਦੇਖ ਲਈਏ ਕਿਉਂਕਿ ਉਹ ਆਪਣੇ ਲੋਕਲ ਪੈਂਦੀ ਹੈ ਜਿਹਦੇ ਵਿੱਚ ਸਾਨੂੰ ਜਾਣ ਆਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ ਤਾਂ ਅਸੀਂ ਸਮੇਂ ਸਿਰ ਜਾ ਵੀ ਸਕਦੇ ਹਾਂ ਅਤੇ ਉੱਥੇ ਜਿਹੜਾ ਫੀਸ ਸਟਕਚਰ ਆ ਉਹ ਵੀ ਵਧੀਆ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਫਿਰ ਤਾਂ ਵਧੀਆ ਗੱਲ ਹੈ ਵੀ ਸਾਡੀ ਜਾਣ ਪਛਾਣ ਹੈਗੀ ਉਹਨਾਂ ਨਾਲ ਅਤੇ ਅਸੀਂ ਫਿਰ ਉਹਨਾਂ ਨੂੰ ਮਿਲ ਲੈਂਦੇ ਹਾਂ ਹਾਂਜੀ ਫਿਰ ਆਪਾਂ ਇਕੱਠੇ ਜਾ ਕੇ ਮਿਲ ਲਾਂਗੇ ਅਤੇ ਉੱਥੇ ਜਿਹੜੇ ਐਡਮਿਸ਼ਨ ਦੇ ਫੋਰਮੈਲਟੀਜ ਨੇ ਫੋਰਮਸ ਵੈਰਾ ਵਗੈਰਾ ਨੇ ਉਹ ਆਪਾਂ ਫਿਲ ਕਰ ਦਾਂਗੇ ਉੱਥੇ ਠੀਕ ਹੈ ਜੀ ਓਕੇ ਥੈਂਕ ਯੂ ਸਤਿ ਸ਼੍ਰੀ ਅਕਾਲ